ਪੰਜਾਬ ਵਿੱਚ ਪ੍ਰਮੁੱਖ ਖੇਡਾਂ ਇਹ ਹਨ ਕ੍ਰਿਕੇਟ ਫੁੱਟਬੋਲ ਟੈਨਿਸ ਬੈਡਮਿੰਟਨ ਅਤੇ ਹਾਕੀ ਹਾਕੀ ਸਾਡੇ ਦੇਸ਼ ਦੀ ਨੈਸ਼ਨਲ ਖੇਡ ਹੈ ਅਤੇ ਕ੍ਰਿਕਟ ਸਭ ਦੀ ਮਨ ਭਾਉਂਦੀ ਖੇਡ ਹੈ ਇਸ ਖੇਡ ਨੂੰ ਸਭ ਆਪਣੇ ਘਰਾਂ ਵਿੱਚ ਬੈਠ ਕੇ ਟੀ ਵੀ 'ਤੇ ਦੇਖਦੇ ਹਨ ਅਤੇ ਵੱਡੇ ਤੋਂ ਛੋਟੇ ਬੱਚੇ ਇਸ ਨੂੰ ਗਲੀ ਜਾਂ ਮੈਦਾਨ ਜਾਂ ਪਾਰਕ ਵਿੱਚ ਖੇਡਣ ਜਾਂਦੇ ਹਨ ਅਤੇ ਫੁੱਟਬੋਲ ਵਿੱਚ ਹਰ ਕੋਈ ਮੈਸੀ ਜਾਂ ਰਨਾਲਡੋ ਬਣਨਾ ਚਾਹੁੰਦਾ ਹੈ ਇਸ ਤਰ੍ਹਾਂ ਇਹ ਖੇਡਾਂ ਸਾਡੇ ਪੰਜਾਬ ਦੀਆਂ ਪ੍ਰਮੁੱਖ ਖੇਡਾਂ ਹਨ